ਘਰ ਦੇ ਵਿੱਚ ਸਿਲਾਈ ਕਢਾਈ ਦਾ ਕੰਮ ਸਾਰਾ ਕੀਤਾ ਜਾ ਸਕਦਾ ਹੈ ਮੈਂ ਕਰਦੀ ਵੀ ਹਾਂ ਬਚਪਨ ਤੋਂ ਹੀ ਕਰਦੀ ਹਾਂ ਆਪਣੇ ਕੱਪੜੇ ਬਣਾਉਣਾ ਬੱਚਿਆਂ ਦੇ ਕੱਪੜੇ ਬਣਾਉਣਾ ਕੋਟੀਆਂ ਸਵਾਟਰ ਜਾਕਟਾਂ ਵਗੈਰਾ ਬਣਾਉਣੀਆਂ ਅਤੇ ਸੇਲ ਕਰਨਾ ਸਾਰੇ ਕੰਮ ਕਰਦੀ ਹਾਂ ਅਤੇ ਸਾਰਾ ਸਿਲਾਈ ਦੇ ਵਿੱਚ ਉਹ ਵੀ ਕੁਛ ਬਣਾਉਣਾ ਰੁਮਾਲ ਟੋਪੀ ਉਹ ਸਾਰਾ ਕੁਛ ਬਣਾਉਂਦੀ ਹਾਂ ਅਤੇ ਜੁਰਾਬਾਂ ਬੱਚਿਆਂ ਦੇ ਬੂਟ ਵਗੈਰਾ ਜੋ ਵੀ ਕੁਛ ਹੁੰਦਾ ਬੱਚਿਆਂ ਦੇ ਸਰਦੀਆਂ 'ਚ ਪਾਉਣ ਵਾਲਾ ਗਰਮੀਆਂ 'ਚ ਪਾਉਣ ਵਾਲਾ ਸਾਰਾ ਕੁਛ ਬਣਾ ਲੈਂਦੀ ਹਾਂ ਅਤੇ ਜੈਂਟਸ ਵੀ ਬਣਾ ਲੈਂਦੀ ਹਾਂ ਲੇਡੀਜ ਵੀ ਬਣਾ ਲੈਂਦੀ ਹਾਂ ਉਹਨਾਂ ਦਾ ਕੰਮ ਵੀ ਸਾਰਾ ਘਰਾਂ ਘਰ ਦੇ ਸਾਰੇ ਕੰਮ ਕਰਾਂ ਰਹੀ ਦਰੀਆਂ ਵਗੈਰਾ ਜੋ ਵੀ ਕੁਛ ਬਣਦਾ ਘਰਾਂ ਦੇ ਵਿੱਚ ਸਾਰਾ ਕੁਛ ਬਣਾ ਲੈਂਦੀ ਜੀ ਦਰੀਆਂ ਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਕੰਮ ਕਰ ਲੈਂਦੀ ਹਾਂ ਦਰੀਆਂ ਬਣਾਉਣ ਦਾ ਬਾਕੀ ਕੋਟੀ ਸਵਾਟਰ ਸਾਰੇ ਚੀਜ਼ਾਂ ਬਣਾ ਲੈਂਦੀ ਹਾਂ ਜੀ ਠੀਕ ਹੈ ਜੀ ਘਰ ਦੇ ਇਹੀ ਕੰਮ ਹੁੰਦੇ ਨੇਗੇ ਬਾਕੀ ਸਾਫ ਸਫਾਈ ਸਾਰਾ ਕੁਛ ਕਰ ਲੈਂਦੇ ਜੀ ਘਰ ਦਾ ਜੋ ਵੀ ਘਰ ਕੰਮ ਹੁੰਦਾ ਅਤੇ ਕੱਪੜੇ ਧੋਣ ਤੋਂ ਲੈ ਕੇ ਸਾਰੇ ਕੰਮ ਆਪ ਹੀ ਕਰੀਦੇ ਨੇ ਇਹੀ ਕੰਮ ਹੁੰਦੇ ਨੇ ਜੀ ਵਿਲੱਖਣ ਕੰਮ ਠੀਕ ਹੈ ਅਤੇ